ਭਵਿੱਖ ਵਿੱਚ ਪੰਜਾਬੀ ਭਾਸ਼ਾ ਨੂੰ ਬਹੁਤ ਅੱਗੇ ਵਧਾਇਆ ਜਾ ਸਕਦਾ ਹੈ ਤੇ ਇਸ ਦੀ ਸੁਰੱਖਿਆ ਰੱਖਿਆ ਜਾ ਸਕਦੀ ਹੈ ਪੰਜਾਬ ਵਿੱਚ ਜ਼ਿਆਦਾਤਰ ਪੰਜਾਬੀ ਹੀ ਬੋਲੀ ਜਾਂਦੀ ਹੈ ਅਤੇ ਸਕੂਲ ਵਿੱਚ ਵੀ ਸਰਕਾਰੀ ਸਕੂਲਾਂ ਵਿੱਚ ਵੀ ਪੰਜਾਬੀ ਜ਼ਰੂਰੀ ਹੋ ਗਈ ਲਾਜ਼ਮੀ ਅਤੇ ਜਿੰਨੇ ਵੀ ਹੈ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਰੱਖਦੇ ਹੈ ਅਤੇ ਕਿਤਾਬਾਂ ਕਵਿਤਾਵਾਂ ਕਹਾਵਤਾਂ ਇਹ ਸਾਰੀਆਂ ਪੰਜਾਬੀ ਭਾਸ਼ਾ ਵਿੱਚ ਹੀ ਹਨ ਅਤੇ ਇਨ੍ਹਾਂ ਨੂੰ ਸ ਸਰਕਾਰੀ ਸਕੂਲਾਂ ਵਿੱਚ ਵੀ ਅੱਗੇ ਸੁਰੱਖਿਆ ਰੱਖਿਆ ਜਾ ਰਹੀ ਹੈ ਅਤੇ ਲਾਜ਼ਮੀ ਕਰਤਾ ਅਤੇ ਦਸਵੀਂ ਵਿੱਚ ਵੀ ਪੰਜਾਬੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਕਿਸੇ ਨੇ ਜੋ ਨੌਕਰੀ ਕਰਨੀ ਹੈ ਤਾਂ ਦਸਵੀਂ ਦੇ ਸਰਟੀਫਿਕੇਟ ਵਿੱਚ ਵੀ ਪੰਜਾਬੀ ਭਾਸ਼ਾ ਦੇਖੀ ਜਾਂਦੀ ਹੈ ਕਿ ਪੰਜਾਬੀ ਦਾ ਪੇਪਰ ਦਾ ਦਿਆ ਹੋਇਆ ਹੈ ਇਸ ਲਈ ਇਹ ਸੁਰੱਖਿਅਤ ਹੈ